ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਸਰ ਆਉਣਾ ਹੈ ਮੈਂ ਦਸ ਵਜੇ ਜੀ ਹੁਣ ਹਾਂਜੀ ਹਾਂਜੀ ਜਿਵੇਂ ਤੁਸੀਂ ਕਹਿੰਦੇ ਹੋ ਹਾਂਜੀ ਹਾਂਜੀ ਤੁਸੀਂ ਦੱਸ ਦਿਓ ਫਿਰ ਮੈਨੂੰ ਆਈਡੀਆ ਹੋਜੂ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਕੋਈ ਗੱਲ ਨਹੀਂ ਮੈਂ ਆ ਜਾਊਂਗੀ ਜੀ